ਪੰਜਾਬ ਵਿੱਚ ਮੱਝਾਂ ਗਾਵਾਂ ਦੁੱਧ ਦੇਣ ਦੇ ਕੰਮ ਆਉਂਦੀਆਂ ਹਨ ਘੋੜੇ ਵੀ ਪਾਲੇ ਜਾਂਦੇ ਹਨ ਵਿਆਹ ਸ਼ਾਦੀ ਦੇ ਵਿੱਚ ਕੰਮ ਆਉਂਦੇ ਨੇ ਹੋਰ ਭੇਡ ਬੱਕਰੀਆਂ ਸਭ ਨੂੰ ਵੀ ਪੰਜਾਬ ਦੇ ਵਿੱਚ ਭੇਡਾਂ ਦੀ ਉੱਨ ਕੰਮ ਆਉਂਦੀ ਹੈ ਬੱਕਰੀਆਂ ਵੀ ਦੁੱਧ ਦਿੰਦੀਆਂ ਉਹ ਵੀ ਕੰਮ ਆਉਂਦੀਆਂ ਨੇ ਕਾਫ਼ੀ ਲੋੜਾਂ ਪੂਰੀਆਂ ਪਸ਼ੂ ਕਰਦੇ ਇਹ ਵਾਲੀਆਂ ਖੇਤੀਬਾੜੀ ਦੇ ਵਿੱਚ ਬੋਲਦ ਕੰਮ ਆਉਂਦੇ ਆ ਬਲਦ ਉਹ ਖੇਤੀਬਾੜੀ ਦੇ ਵਿੱਚ ਪਹਿਲੇ ਕੰਮ ਆਉਂਦੇ ਸੀਗੇ ਥੈਂਕ ਯੂ